ਹੈਲੋ ਸਤਿ ਸ਼੍ਰੀ ਅਕਾਲ ਜੀ ਆਪਣਾ ਸੈਲੀਬਰੇਸ਼ਨ ਹੋਟਲ ਤੋਂ ਬੋਲ ਰਹੇ ਹੋ ਮੈਂ ਖਾਣਾ ਔਰਡਰ ਕਰਨਾ ਸੀ ਹੋਮ ਡਿਲੀਵਰੀ ਕਰਦੇ ਹੋ ਤੁਸੀਂ ਓਕੇ ਇੱਕ ਆਪਣਾ ਸ਼ਾਹੀ ਪਨੀਰ ਦਾਲ ਮੱਖਣੀ ਮਿਕਸ ਵੈੱਜ ਦੋ ਸਟਫ ਨਾਨ ਆਪਣਾ ਮਿੱਸੀ ਰੋਟੀ ਵਿਦ ਓਨੀਅਨ ਅਤੇ ਕਿੰਨੇ ਕੁ ਟੈਮ ਤੱਕ ਪਹੁੰਚਦੀ ਕਰੋਗੇ ਜੀ ਓਕੇ ਅਤੇ ਐਡਰੈਸ ਨੋਟ ਕਰੋ ਵਾਰਡ ਨੰਬਰ ਤੇਰ੍ਹਾਂ ਗਲੀ ਨੰਬਰ ਸੱਤ ਆਪਣਾ ਰਾਮ ਬਾਗ ਦੇ ਨੇੜੇ ਜੀ ਹਾਂਜੀ ਇਹ ਕਿੰਨੇ ਕੁ ਟੈਮ ਤੱਕ ਆਜੂਗਾ ਟਵੰਟੀ ਮਿਨਟਸ ਓਕੇ ਅਤੇ ਥੋੜ੍ਹਾ ਸਪਾਈਸੀ ਘੱਟ ਰੱਖਣਾ ਜੀ ਇਹ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੈ ਛੇਤੀ ਪਹੁੰਚਦਾ ਕਰ ਦਿਓ ਉਹ ਕਰਿਓ ਅਤੇ ਡਿਸਕਾਊਂਟ ਵੀ ਚੱਲ ਰਿਹਾ ਕੋਈ ਅੱਜ ਠੀਕ ਹੈ ਜੀ ਓਕੇ ਥੈਂਕ ਯੂ